ਕਲਪਨਾ ਚਾਵਲਾ ਦੁਨੀਆ ਦੀ ਪਹਿਲੀ ਇੱਕ ਅਜਿਹੀ ਔਰਤ ਹੈ ਜਿਸਨੇ ਚੰਦ 'ਤੇ ਪਹੁੰਚ ਕੇ ਆਪਣੇ ਭਾਰਤ ਦੇਸ਼ ਦਾ ਨਾਮ ਰੋਸ਼ਨ ਕੀਤਾ ਸੀ ਅਤੇ ਇਸ ਦਾ ਜਨਮ ਕਰਨਾਲ ਦੇ ਵਿੱਚ ਹੋਇਆ ਸੀ ਅਤੇ ਪੜ੍ਹਾਈ ਦੇ ਵਿੱਚ ਇਸ ਨੇ ਨੌਟਿਕਲ ਇੰਜੀਨੀਅਰਿੰਗ ਦੀ ਡਿਗਰੀ ਹਾਸਿਲ ਕੀਤੀ ਸੀ ਚੰਡੀਗੜ੍ਹ ਤੋਂ ਅਤੇ ਸਭ ਤੋਂ ਪਹਿਲਾਂ ਇਸਨੇ ਪਹਿਲੀ ਉਡਾਣ 'ਚ ਇੱਕ ਕਰੋੜ ਮੀਲ ਦੀ ਯਾਤਰਾ ਕੀਤੀ ਸੀ ਜਿਸਦੇ ਵਿੱਚ ਇਸਨੇ ਤਿੰਨ ਸੌ ਬਹੱਤਰ ਘੰਟੇ ਕੱਢੇ ਸੀ ਉਸ ਤੋਂ ਬਾਅਦ ਉੱਨੀ ਸੋ ਅਠਾਸੀ ਦੇ ਨਾਸਾ ਦੇ ਏਮਸ ਸੈਂਟਰ 'ਚ ਇਸ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਫਿਰ ਉੱਨੀ ਸੌ ਪਚਾਨਵੇਂ ਦੇ ਵਿੱਚ ਇਸਨੇ ਚੇਨ ਅੰਤਰਿਕਸ਼ ਦੀ ਯਾਤਰਾ ਕੀਤੀ ਸੀ ਫਿਰ ਆਖਰਕਾਰ ਇੱਕ ਫਰਵਰੀ ਦੋ ਹਜ਼ਾਰ ਤਿੰਨ ਦੇ ਸ ਸਵੇਰੇ ਇੱਕ ਫਰਵਰੀ ਦੋ ਹਜ਼ਾਰ ਤਿੰਨ ਦੇ ਵਿੱਚ ਜੋ ਉਸਦੀ ਆਖਰੀ ਉਡਾਣ ਸੀ ਉਸ ਉਡਾਣ ਦੇ ਵਿੱਚ ਇੱਕ ਫਰਵਰੀ ਨੂੰ ਸਵੇਰ ਦੇ ਟਾਈਮ ਇਸ ਦੀ ਮੌਤ ਹੋ ਗਈ ਸੀ ਜਿਸ ਦੇ ਨਾਲ ਛੇ ਅੰਤਰਿਕਸ਼ ਯਾਤਰੀਆਂ ਦੀ ਵੀ ਇਸ ਦੇ ਨਾਲ ਮੌਤ ਹੋ ਗਈ ਸੀ ਇਸ ਨੇ ਚੰਦ ਦੇ ਉੱਤੇ ਪਹੁੰਚ ਕੇ ਰਿਸਰਚ ਕੀਤੀ ਅਤੇ ਆਪਣੇ ਭਾਰਤ ਦੇ ਦੇਸ਼ ਦਾ ਮਾਣ ਬਹੁਤ ਵਧਾਇਆ ਹੈ